ਮੈਂ ਪੰਜਾਬ ਦਾ ਰਹਿਣ ਵਾਲਾ ਅਤੇ ਪੰਜਾਬ ਦੀ ਗੱਲ ਕਰਦਾ ਹਾਂ ਸਾਡੀ ਪੰਜਾਬ ਸਿਆਸੀ ਪਾਰਟੀਆਂ ਸਿਆਸੀ ਪਾਰਟੀਆਂ ਕਿਹੜੀਆਂ ਜਿਹੜੇ ਸਾਡੇ ਦੇਸ਼ ਨੂੰ ਜਾਂ ਸਾਡੇ ਰਾਜ ਨੂੰ ਚਲਾਉਂਦੀਆਂ ਹਨ ਸਾਡੀ ਮੁੱਖ ਸਿਆਸੀ ਪਾਰਟੀਆਂ ਪੰਜਾਬ ਦੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਬੀ ਜੇ ਪੀ ਭਾਰਤੀ ਜਨਤਾ ਪਾਰਟੀ ਅਤੇ ਬੀ ਐਸ ਟੀ ਬਹੁਜਨ ਸਮਾਜ ਪਾਰਟੀ ਸਭ ਤੋਂ ਜ਼ਿਆਦਾ ਪੰਜਾਬ ਵਿੱਚ ਚੱਲਣ ਵਾਲੀ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਤਕਰੀਬਨ ਉੱਨੀ ਸੌ ਵੀਹ ਦੇ ਵਿੱਚ ਕੀਤੀ ਗਈ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਲੰਬੇ ਸਮੇਂ ਤੋਂ ਇਕੱਲੀ ਹੀ ਪਾਰਟੀ ਆਪਦੇ ਦਮ 'ਤੇ ਪੰਜਾਬ ਵਿਚ ਆਪਦਾ ਵਿਗਲ ਵਜਾਉਂਦੀ ਰਹੀ ਸ਼੍ਰੋਮਣੀ ਅਕਾਲੀ ਦਲ ਦੇ ਮੇਨ ਸੀ ਐਮ ਜੋ ਰਹੇ ਉਹ ਪ੍ਰਕਾਸ਼ ਸਿੰਘ ਬਾਦਲ ਰਹੇ ਜਿਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਥੱਲੋਂ ਦੀ ਲੈ ਕੇ ਉੱਪਰ ਤੱਕ ਬੜੇ ਲੈਵਲ ਤੱਕ ਪਹੁੰਚਾਇਆ ਸ਼੍ਰੋਮਣੀ ਅਕਾਲੀ ਦਲ ਜਿਹੜੀ ਅਕਾਲੀ ਦਲ ਦੀ ਪਾਰਟੀ ਹੈ ਇਹਨੇ ਪੰਜਾਬ ਦੇ ਵਿੱਚ ਬੀ ਜੇ ਪੀ ਦੇ ਨਾਲ ਸਮਝੌਤਾ ਕੀਤਾ ਬੀ ਜੇ ਪੀ ਦੇ ਨਾਲ ਰਲ ਕੇ ਉਹਨਾਂ ਨੇ ਕਈ ਵਾਰੀ ਕਈ ਚੁਨਾਵਾਂ ਲੜੀਆਂ ਅਤੇ ਚੁਨਾਵਾਂ ਲੜ ਕੇ ਜਿੱਤਾਂ ਵੀ ਕੀਤੀਆਂ ਅਤੇ ਪੰਜਾਬ ਵਿੱਚ ਆਪਦਾ ਰਾਜ ਵੀ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਜੋ ਪ੍ਰਕਾਸ਼ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਸਮਝ ਲਓ ਸ਼੍ਰੋਮਣੀ ਅਕਾਲੀ ਦਲ ਨੂੰ ਚਲਾਉਣ ਵਾਲੇ ਮੁੱਖ ਨੇਤਾ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਜਦੋਂ ਬਾਦਲ ਸਾਹਿਬ ਡਾਊਨ ਹੋਏ ਬਾਦਲ ਸਾਹਿਬ ਬਿਮਾਰ ਹੋਏ ਤਾਂ ਉਹਨਾਂ ਦਾ ਜੋ ਮੁੱਖ ਉੱਤਰਾਧਿਕਾਰੀ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਜਦੋਂ ਬਾਦਲ ਸਾਹਿਬ ਦੀ ਡੈਥ ਹੋ ਗਈ ਬਾਦਲ ਸਾਹਿਬ ਦਾ ਦੇਂਹਾਤ ਹੋ ਗਿਆ ਤਾਂ ਮੁੱ ਜਿਹੜੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਡਾਊਨਫਾਲ ਹੈ ਥੋੜ੍ਹਾ ਜਿਹਾ ਸ਼ੁਰੂ ਹੋ ਗਿਆ ਪੰਜਾਬ ਵਿੱਚ ਹੋਰ ਪਾਰਟੀਆਂ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਜੋ ਇੱਕ ਨੈਸ਼ਨਲ ਪਾਰਟੀ ਹੈ ਜੋ ਹਮੇਸ਼ਾ ਹੀ ਕਿਉਂਕਿ ਹਮੇਸ਼ਾ ਹੀ ਕਿਸੇ ਵੀ ਰਾਜ ਦੇ ਵਿੱਚ ਇੱਕ ਸ਼ ਇੱਕ ਸੇਤ ਖੇਤਰੀ ਪਾਰਟੀ ਹੁੰਦੀ ਹੈ ਅਤੇ ਦੂਜੀ ਨਾਲ ਨੈਸ਼ਨਲ ਪਾਰਟੀ ਤਾਂ ਰਹਿੰਦੀ ਰਹਿੰਦੀ ਹੈ ਤਾਂ ਜਿਹੜੇ ਵੋਟਰ ਹੁੰਦੇ ਨੇ ਉਹ ਖੇਤਰੀ ਪਾਰਟੀ ਦੇ ਵੀ ਹੁੰਦੇ ਨੇ ਅਤੇ ਨੈਸ਼ਨਲ ਪਾਰਟੀ ਦੇ ਵੀ ਹੁੰਦੇ ਨੇ ਨੈਸ਼ਨਲ ਪਾਰਟੀ ਕਾਂਗਰਸ ਦੇ ਵੋਟਰ ਹਮੇਸ਼ਾ ਹੀ ਰਹੇ ਨੇ ਅਤੇ ਕਾਂਗਰਸ ਦੀ ਸੀਟਾਂ ਹਮੇਸ਼ਾ ਹੀ ਰਹੀਆਂ ਨੇ ਸਮੇਂ ਬਦਲਦਾ ਰਿਹਾ ਕਦੇ ਅਕਾਲੀ ਦਲ ਦੀ ਸਰਕਾਰ ਆ ਗਈ ਕਦੇ ਕਾਂਗਰਸ ਦੀ ਸਰਕਾਰ ਆ ਗਈ ਅਤੇ ਕਾਂਗਰਸ ਦੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਕਾਫੀ ਦੇਰ ਸੀ ਐਮ ਰਹੇ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਬੀ ਜੇ ਪੀ ਦਾ ਵੀ ਕਾਫੀ ਜ਼ਿਆਦਾ ਜੋਰ ਰਿਹਾ ਬੀ ਜੇ ਪੀ ਹਮੇਸ਼ਾ ਅਕਾਲੀ ਦੇ ਦੌਰਾਨ ਮਿਲ ਕੇ ਹੀ ਲੜਦੀ ਰਹੀ ਇਹ ਚੁਨਾਵ ਵੋਟਾਂ ਲੜਦੀ ਰਹੀ ਲੇਕਿਨ ਪਿੱਛੇ ਬਾਦਲ ਸਾਹਿਬ ਦੇ ਟਾਈਮ ਉਹਨਾਂ ਦਾ ਆਪਸ ਦੇ ਵਿੱਚ ਕੀ ਹੋ ਗਿਆ ਵੱਖ ਹੋ ਗਿਆ ਤਾਂ ਅਕਾਲੀ ਦਲ ਕੀ ਹੋ ਗਏ ਵੱਖ ਹੋ ਕੇ ਉਹਨਾਂ ਨੇ ਬੀ ਐਸ ਪੀ ਬਹੁਜਨ ਸਮਾਜ ਪਾਰਟੀ ਦੇ ਨਾਲ ਆਪਦਾ ਚੁਣਾਵ ਲੜਿਆ ਅਤੇ ਬੀ ਜੇ ਪੀ ਨੇ ਇਕੱਲੇ ਆਪਦਾ ਚੁਣਾਵ ਲੜਿਆ ਲੇਕਿਨ ਹੁਣ ਜੋ ਪੰਜਾਬ ਵਿੱਚ ਮੇਨ ਪਾਰਟੀ ਉੱਭਰ ਕੇ ਆਈ ਉਹ ਪਿੱਛੇ ਆਪ ਆਮ ਜਨਤਾ ਪਰ ਆਮ ਆਮ ਪਾਰਟੀ ਆਮ ਪਾਰਟੀ ਕੀ ਹੈ ਲੋਕਾਂ ਦੇ ਵਿੱਚ ਇੱਕ ਹਵਾ ਬੜੀ ਹੋ ਗਈ ਸੀ ਲੋਕਾਂ ਦੇ ਵਿੱਚ ਲੋਕ ਦੋਨੋਂ ਪਾਰਟੀਆਂ ਤੋਂ ਕਾਂਗਰਸ ਤੋਂ ਅਕਾਲੀ ਦਲ ਤੋਂ ਅੱਕ ਚੁੱਕੇ ਸੀ ਤਾਂ ਦਿੱਲੀ ਦੇਸ਼ ਕੇਜਰੀਵਾਲ ਦੀ ਪਾਰਟੀ ਆਮ ਨੇ ਬੜਾ ਜ਼ਿਆਦਾ ਆਪਦਾ ਰੂਪ ਵਿਖਾਇਆ ਸੀ ਤਾਂ ਪੰਜਾਬ ਦੇ ਲੋਕਾਂ ਨੇ ਵੀ ਵੱਧ ਚੜ੍ਹ ਕੇ ਆਪ ਦੇ ਉੱਤੇ ਭਰੋਸਾ ਕੀਤਾ ਅਤੇ ਇਹ ਤਰੀਕੇ ਨਾਲ ਵੋਟਾਂ ਪਾਈਆਂ ਕਿ ਪੰਜਾਬ ਦੇ ਵਿੱਚ ਇੱਕ ਸੌ ਸਤਾਰ੍ਹਾਂ ਸੀਟਾਂ ਦੇ ਵਿੱਚੋਂ ਬਾਨ੍ਹਵੇਂ ਸੀਟਾਂ ਆਮ ਆਦਮੀ ਪਾਰਟੀ ਲੈ ਗਈ